ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕੋਈ ਮੂਲ ਕਲਾ ਰੂਪ ਜਾਂ ਸ਼ਿਲਪਕਾਰੀ ਨਹੀਂ ਹੈ ਪਰ ਜੇਕਰ ਅਸੀਂ ਗੱਲ ਕਰੀਏ ਕਿ ਇੱਥੋਂ ਦੀ ਪੇਂਟਿੰਗ ਮੂਰਤੀ ਟੈਕਸਟਾਈਲ ਬਰਤਨ ਜਾਂ ਛਪਾਈ ਇਹ ਵੀ ਕੁਝ ਖਾਸ ਨਹੀਂ ਹਨ ਸਭ ਤੋਂ ਪਹਿਲਾਂ ਸਾਡੇ ਕੋਲ ਹੈ ਮੂਰਤੀ ਜੇਕਰ ਅਸੀਂ ਮੂਰਤੀ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਰਹਿਣ ਵਾਲੇ ਲੋਕ ਜ਼ਿਆਦਾਤਰ ਸਰਦਾਰ ਹਨ ਅਤੇ ਇਸ ਕਰਕੇ ਉੱਥੇ ਮੂਰਤੀਆਂ ਬਹੁਤ ਹੀ ਘੱਟ ਬਣਦੀਆਂ ਹਨ ਅਤੇ ਨਾ ਹੀ ਉੱਥੋਂ ਦੀ ਕੋਈ ਵੀ ਮੂਰਤੀ ਜਾਂ ਮੰਦਰ ਇੰਨਾ ਫੇਮਸ ਹੈ ਅਤੇ ਦੂਸਰੇ ਨੰਬਰ 'ਤੇ ਸਾਡੇ ਕੋਲ ਆਉਂਦਾ ਹੈ ਛਪਾਈ ਛਪਾਈ ਦਾ ਕੰਮ ਦਾ ਮਤਲਬ ਹੁੰਦਾ ਹੈ ਪੇਂਟਿੰਗ ਕਰਨੀ ਜਿੱਦਾਂ ਕਿ ਸੂਟਾਂ 'ਤੇ ਪੇਂਟਿੰਗ ਕਰਨੀ ਬਲੋਕ ਪੇਂਟਿੰਗ ਕਰਨੀ ਇਹ ਵੀ ਇਹ ਗੁਰਦਾਸਪੁਰ ਵਿੱਚ ਵੀ ਕੰਮ ਕੀਤਾ ਜਾਂਦਾ ਹੈ ਪਰ ਗੁਰਦਾਸਪੁਰ ਤੋਂ ਇਲਾਵਾ ਜਿਵੇਂ ਕਿ ਅੰਮ੍ਰਿਤਸਰ ਬਟਾਲਾ ਅਤੇ ਹੋਰ ਵੀ ਕਈ ਸ਼ਹਿਰਾਂ ਦੇ ਵਿੱਚ ਕਢਾਈ ਦਾ ਕੰਮ ਆਮ ਤੌਰ 'ਤੇ ਕੀਤਾ ਜਾਂਦਾ ਹੈ ਇਸ ਵਿੱਚ ਵੀ ਗੁਰਦਾਸਪੁਰ ਦਾ ਕੋਈ ਖਾਸ ਕੋਈ ਖਾਸ ਮੋਟਿਵ ਨਹੀਂ ਹੈ ਜੋ ਗੁਰਦਾਸਪੁਰ ਵਿੱਚ ਤੁਹਾਨੂੰ ਮਿਲਦਾ ਹੈ ਉਹ ਤੁਹਾਨੂੰ ਅੰਮ੍ਰਿਤਸਰ ਵਿੱਚ ਵੀ ਜਾ ਕੇ ਮਿਲ ਸਕਦਾ ਹੈ ਬਲਕਿ ਅੰਮ੍ਰਿਤਸਰ ਵਿੱਚ ਅੰਮ੍ਰਿਤਸਰ ਸ਼ਹਿਰ ਵਿੱਚ ਤਬਕੀ ਦੀ ਕਢਾਈ ਕੀਤੀ ਜਾਂਦੀ ਹੈ ਜੋ ਕਿ ਬਹੁਤ ਹੀ ਲੋਕਾਂ ਨੂੰ ਪਸੰਦ ਆਉਂਦੀ ਹੈ ਅਤੇ ਉੱਥੋਂ ਦੇ ਸੂਟ ਵੀ ਕਾਫੀ ਲੋਕ ਪਸੰਦ ਕਰਦੇ ਹਨ ਉਸ ਤੋਂ ਬਾਅਦ ਸਾਡੇ ਕੋਲ ਹੈ ਟੈਕਸਟਾਈਲ ਟੈਕਸਟਾਈਲ ਦੇ ਮਾਮਲੇ ਦੇ ਵਿੱਚ ਗੁਰਦਾਸਪੁਰ ਵਿੱਚ ਕੋਈ ਵੀ ਫੈਕਟਰੀ ਨਹੀਂ ਹੈ ਬਲਕਿ ਅੰਮ੍ਰਿਤਸਰ ਵਿੱਚ ਫੈਕਟਰੀ ਹੈ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਲੋਕ ਅੰਮ੍ਰਿਤਸਰ ਵਿੱਚ ਜਾ ਕੇ ਕੰਮ ਕਰਦੇ ਹਨ ਕਾਫੀ ਸਾਰੇ ਲੋਕ ਇੱਥੋਂ ਗੁਰਦਾਸ ਗੁਰਦਾਸਪੁਰ ਤੋਂ ਅੰਮ੍ਰਿਤਸਰ ਜਾਂਦੇ ਹਨ ਅਤੇ ਉੱਥੇ ਕੰਮ ਕਰਦੇ ਹਨ ਜੇਕਰ ਅਸੀਂ ਗੱਲ ਕਰੀਏ ਬਰਤਨ ਦੀ ਤਾਂ ਜਿਵੇਂ ਕਿ ਅ ਅਸੀਂ ਪੁਰਾਣੇ ਜ ਜਿਵੇਂ ਕਿ ਅਸੀਂ ਪੁਰਾਣੇ ਸਮੇਂ ਦੇ ਵਿੱਚ ਘੜੇ ਦੇ ਭਾਂਡੇ ਵਰਤਦੇ ਹਾਂ ਉਹ ਗੁਰਦਾਸਪੁਰ ਵਿੱਚੋਂ ਵੀ ਮਿਲ ਜਾਣਗੇ ਤਾਂ ਕਿਸੇ ਹੋਰ ਸ਼ਹਿਰ ਵਿੱਚੋਂ ਵੀ ਮਿਲ ਜਾਣਗੇ ਸੋ ਮੁੱਕਦੀ ਗੱਲ ਇਹ ਹੈ ਕਿ ਗੁਰਦਾਸਪੁਰ ਵਿੱਚ ਕੋਈ ਵੀ ਐਸੀ ਖਾਸ ਜਾਂ ਵਿਲੱਖਣ ਗੱਲ ਨਹੀਂ ਹੈ ਜੋ ਕਿ ਉਸਦੀ ਮੂਲ ਕਲਾ ਰੂਪ ਜਾਂ ਸ਼ਿਲਪਕਾਰੀ ਹੋਵੇ